ਚਾਰ ਫ਼ਰਵਰੀ ਦੋ ਹਜ਼ਾਰ ਬਾਰਾਂ ਪੰਜ ਨਵੰਬਰ ਦੋ ਹਜ਼ਾਰ ਉੱਨੀ ਦਸ ਮਾਰਚ ਦੋ ਹਜ਼ਾਰ ਵੀਹ ਸਤਾਈ ਮਈ ਦੋ ਹਜ਼ਾਰ ਚੌਦਾਂ ਅਠਾਰਾਂ ਅਗਸਤ ਦੋ ਹਜ਼ਾਰ ਬਾਈ